ਸਦੀਆਂ ਤੋਂ ਅਨੇਕਾਂ ਖਗੋਲ ਵਿਗਿਆਨੀ ਇਸ ਧਰਤੀ 'ਤੇ ਵਿਚਰੇ ਅਤੇ ਆਪੋ ਆਪਣੀ ਸਮਝ ਅਨੁਸਾਰ ਖਗੋਲ ਬਾਰੇ ਜਾਣਕਾਰੀ ਦਿੰਦੇ ਰਹੇ ਇਹਨਾਂ ਸਭ ਦੀਆਂ ਲਿਖਤਾਂ ਅੱਜ ਵੀ ਅਤੇ ਆਉਣ ਵਾਲੇ ਸਮੇਂ 'ਚ ਵੀ ਖਗੋਲ 'ਚ ਰੁਚੀ ਰੱਖਣ ਵਾਲਿਆਂ ਲਈ ਮਾਰਗਦਰਸ਼ਨ ਦਾ ਕੰਮ ਕਰਨਗੀਆਂ ਮਹਾਨ ਖਗੋਲ ਵਿਗਿਆਨੀ ਜਿਵੇਂ ਗਲੀਲੀਓ ਕਾਪਰਨਿਕਸ ਹਬਲ ਸਟੀਫਨ ਹਾਕਿੰਗ ਅਤੇ ਹੋਰ ਵੀ ਅਨੇਕਾਂ ਜਿਹਨਾਂ ਦੀ ਖੋਜ ਇਸ ਬੇਅੰਤ ਬ੍ਰਹਿਮੰਡ 'ਚ ਇੱਕ ਨਿੱਕੇ ਪਰ ਅਨਮੋਲ ਬਿੰਦੂ ਦਾ ਕੰਮ ਕਰ ਰਹੀ ਹੈ ਦੂਜੇ ਪਾਸੇ ਗ੍ਰਹਿਆਂ ਦੀ ਸਥਿਤੀ ਅਤੇ ਜੋਤਿਸ਼ ਵਿਗਿਆਨ ਦੀ ਵੀ ਆਪਣੀ ਇੱਕ ਜਗ੍ਹਾ ਹੈ ਜਿਵੇਂ ਕੋਈ ਸ਼ੁਭ ਕੰਮ ਸ਼ੁਰੂ ਕਰਨਾ ਹੋਵੇ ਲਾਈਕ ਜਿਵੇਂ ਗ੍ਰਹਿ ਪ੍ਰਵੇਸ਼ ਜਾਂ ਵਿਆਹ ਵਰਗਾ ਸ਼ੁਭ ਕੰਮ ਹੋਵੇ ਕੁਝ ਮੱਤ ਦੇ ਲੋਕ ਪਹਿਲਾਂ ਗ੍ਰਹਿਆਂ ਦੀ ਸਥਿਤੀ ਜੋਤਸ਼ੀ ਦੁਆਰਾ ਦੇਖਦੇ ਹਨ ਫਿਰ ਉਹਦੇ ਹਿਸਾਬ ਨਾਲ ਉਚੇਚਾ ਬਣਦਾ ਕਦਮ ਚੁੱਕਦੇ ਹਨ ਪਰ ਇਸ ਦੇ ਉਲਟ ਕੁਝ ਨਿਆਰੀ ਮੱਤ ਵਾਲੇ ਰਾਹ ਜਿਵੇਂ ਸਿੱਖ ਧਰਮ ਗ੍ਰਹਿਆਂ ਅਤੇ ਜੋਤਿਸ਼ ਵਿੱਦਿਆ ਦੇ ਉਲਟ ਚੱਲਦੇ ਹੋਏ ਸਿਰਫ਼ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਧੰਨਵਾਦ